ਸਾਰੇ ਗੁਰੂਆਂ ਵੱਲੋਂ ਇਹੀ ਪ ਪ੍ਰਚਾਰ ਕੀਤਾ ਜਾਂਦਾ ਸੀ ਕਿ ਜਿਹੜੇ ਸਾਰੇ ਹੀ ਧਰਮਾਂ ਦੇ ਲੋਕ ਇੱਕੋਂ ਹੀ ਧਰਮ ਦੇ ਨੇ ਇੱਕੋ ਜਿਹੇ ਨੇ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਰਲ ਮਿਲ ਕੇ ਰਹਿਣਾ ਚਾਹੀਦਾ ਅਤੇ ਜਦੋਂ ਵੀ ਕੋਈ ਯੁੱਧ ਹੁੰਦਾ ਸੀ ਅਤੇ ਸਾਰੀ ਸੈਨਾ ਇਕੱਠੀ ਹੁੰਦੀ ਸੀ ਉਹਦੇ ਵਿੱਚ ਦੇਖਿਆ ਨਹੀਂ ਜਾਂਦਾ ਸੀ ਉਹ ਕਿਹੜੇ ਜਾਤ ਨਾਲ ਰਿਲੇਟਿਡ ਹੈ ਕਿਹੜੇ ਨਾਲ ਨਹੀਂ ਹੈ ਹੈ ਨਾ ਅਤੇ ਜਦੋਂ ਵੀ ਕੋਈ ਯੁੱਧ ਹੁੰਦਾ ਸੀ ਹਰ ਇੱਕ ਜਾਤ ਦੇ ਲੋਕ ਇਕੱਠੇ ਹੁੰਦੇ ਸੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵੀ ਜਿਹੜੇ ਲੜਾਈਆਂ ਲੜੀਆਂ ਗਈਆਂ ਸਾਰੇ ਗੁਰੂਆਂ ਨੇ ਜਿਹੜੀਆਂ ਲੜਾਈਆਂ ਲੜੀਆਂ ਗਈਆਂ ਉਨ੍ਹਾਂ ਵਿੱਚ ਸਾਰੇ ਹੀ ਸੈਨਾ ਇਕੱਠੀ ਕੀਤੀ ਜਾਂਦੀ ਸੀ ਅਤੇ ਸੈਨਾ ਵਿੱਚ ਜਦੋਂ ਸੈਨਿਕ ਰੱਖੇ ਜਾਂਦੇ ਸੀ ਉਦੋਂ ਇਹ ਨਹੀਂ ਸੀ ਦੇਖਿਆ ਜਾਂਦਾ ਕਿ ਉਹ ਕਿਹੜੀ ਜਾਤ ਨਾਲ ਹੈਗਾ ਹੈ ਕਿਹੜੀ ਨਾਲ ਨਹੀਂ ਰਿਲੇਟਡ ਹੈ ਨਾ ਤਾਂ ਜਿਹੜਾ ਵੀ ਹੁੰਦਾ ਸੀ ਉਹਨੂੰ ਰੱਖਿਆ ਜਾਂਦਾ ਸੀ ਅਤੇ ਸਾਰੇ ਲੋਕਾਂ ਨੂੰ ਰਲ ਮਿਲ ਕੇ ਰਹਿਣ ਬਾਰੇ ਕਿਹਾ ਜਾਂਦਾ ਸੀ ਆਜ਼ਾਦੀ ਦੇ ਸਮੇਂ ਵੀ ਸਾਰੇ ਜਿਹੜੇ ਲੋਕ ਸੀਗੇ ਉਹ ਇਕੱਠੇ ਸੀ ਉਹਦੇ ਉਸ ਸਮੇਂ ਵੀ ਦੇਖਿਆ ਨਹੀਂ ਸੀ ਜਾਂਦਾ ਕੌਣ ਕਿਹੜੀ ਜਾਤ ਨਾਲ ਹੈ ਕਿਹੜਾ ਨਹੀਂ ਹੈ ਹੈ ਨਾ ਸਾਰੇ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਜਿਹੜਾ ਸਾਡਾ ਦੇਸ਼ ਹੈ ਉਹ ਆਜ਼ਾਦ ਕਰਵਾਇਆ ਸੀ ਇੱਦਾਂ ਹੀ ਜਦੋਂ ਸਾਰਾ ਟਾਈਮ ਆਉਂਦਾ ਹੈ ਕੋਈ ਵੀ ਟਾਈਮ ਆਉਂਦਾ ਲੜਾਈ ਦਾ ਹੋਵੇ ਕੋਈ ਵੀ ਹੋਵੇ ਖੁਸ਼ੀ ਦਾ ਹੋਵੇ ਉੱਥੇ ਸਾਰੇ ਹੀ ਜਿਹੜੇ ਲੋਕ ਹੈ ਉਹਨਾਂ ਨੂੰ ਇਕੱਠੇ ਰਹਿਣ ਬਾਰੇ ਕਿਹਾ ਜਾਂਦਾ ਸੀ ਕਿ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਨੀਵੀਂ ਜਾਤ ਨਾਲ ਹੈ ਉਹ ਉੱਚੀ ਜਾਤ ਨਾਲ ਹੈ ਇਹਦੇ ਬਾਰੇ ਨਹੀਂ ਸੀ ਸੋਚਣਾ ਚਾਹੀਦਾ ਸਭ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ